ਹੈਲੋ ਸਰ ਕੀ ਤੁਸੀਂ ਸਨੈਕਰਸ ਤੋਂ ਗੱਲ ਕਰ ਰਹੇ ਹੋ ਮੈਂ ਪਰਸੋਂ ਤਮੰਨਾ ਨਾਮ 'ਤੇ ਤੁਹਾਡੇ ਕੋਲੋਂ ਪੀਜ਼ਾ ਅਤੇ ਕੁਝ ਕੋਕ ਦੀਆਂ ਬੋਤਲਾਂ ਔਡਰ ਕੀਤੀਆਂ ਸਨ ਅਤੇ ਤੁਹਾਡਾ ਔਡਰ ਪਰ ਦੋ ਘੰਟੇ ਲੇਟ ਆਇਆ ਸੀ ਇਸ ਕਰਕੇ ਮੈਂ ਤ ਇਹ ਔਡਰ ਕੈਂਸਲ ਕਰ ਦਿੱਤਾ ਸੀ ਕਿਉਂਕਿ ਇਹ ਔਡਰ ਸਿਰਫ ਔਰ ਸਿਰਫ ਮੈਂ ਆਪਣੇ ਰਿਸ਼ਤੇਦਾਰਾਂ ਲਈ ਮੰਗਵਾਇਆ ਸੀ ਅਤੇ ਉਦੋਂ ਤੱਕ ਜਾ ਚੁੱਕੇ ਸਨ ਜਦੋਂ ਤੱਕ ਤੁਹਾਡਾ ਔਡਰ ਆਇਆ ਇਸ ਕਰਕੇ ਉਹਨਾਂ ਸਾਹਮਣੇ ਮੈਨੂੰ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਹੋਣੀ ਪਈ ਕਿਉਂਕਿ ਮੈਂ ਉਨ੍ਹਾਂ ਉਨ੍ਹਾਂ ਦੇ ਸਾਹਮਣੇ ਤੁਹਾਡੀ ਸਨੇਕਰਸ ਦੀ ਬਹੁਤ ਹੀ ਤਾਰੀਫ ਕੀਤੀ ਸੀ ਪਰ ਜਦੋਂ ਤੁਹਾਡਾ ਔਡਰ ਬਹੁਤ ਹੀ ਲੇਟ ਆਇਆ ਤਾਂ ਮੈਨੂੰ ਉਹਨਾਂ ਦੇ ਸਾਹਮਣੇ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਹੋਈ ਇਸ ਕਰਕੇ ਮੈਂ ਤੁਹਾਡਾ ਔਡਰ ਕੈਂਸਲ ਕਰ ਦਿੱਤਾ ਸੀ ਅਤੇ ਮੈਂ ਔਡਰ ਦੀ ਪੇਮੈਂਟ ਔਨਲਾਈਨ ਕੀਤੀ ਸੀ ਪਰ ਅਜੇ ਤੱਕ ਵੀ ਮੇਰੇ ਖਾਤੇ ਵਿੱਚ ਮੇਰੇ ਪੈਸੇ ਵਾਪਸ ਨਹੀਂ ਆਏ ਹਨ ਅਤੇ ਕਿਰਪਾ ਕਰਕੇ ਜਲਦੀ ਤੋਂ ਜਲਦੀ ਮੇਰੇ ਪੈਸੇ ਮੇਰੇ ਖਾਤੇ ਵਿੱਚ ਰਿਫੰਡ ਕੀਤੇ ਜਾਣ ਤਾਂ ਕਿ ਮੈਂ ਅੱਗੇ ਤੋਂ ਜਦੋਂ ਵੀ ਤੁਹਾਡੇ ਤੋਂ ਕੋਈ ਕੁਛ ਵੀ ਮੰਗਵਾਵਾਂ ਤਾਂ ਤੁਸੀਂ ਮੇਰੀ ਤੁਸੀਂ ਮੇਰਾ ਔਡਰ ਜਲਦੀ ਤੋਂ ਜਲਦੀ ਭੇਜ ਦੇਵੋ ਅਤੇ ਮੇਰਾ ਵਿਸ਼ਵਾਸ ਤੁਹਾਡੇ 'ਤੇ ਬਣਿਆ ਰਹੇ ਰਵੇ ਤਾਂ